ਮੂੰਗੀ ਦਾ ਹਲਵਾ ਜੋ ਕਿ ਬਹੁਤ ਹੀ ਸਿਹਤਮੰਦ ਪਕਵਾਨ ਹੈ ਜੋ ਕਿ ਦੇਸੀ ਘਿਓ ਵਿੱਚ ਤਿਆਰ ਹੁੰਦਾ ਹੈ ਜਿਸ ਦੇ ਵਿੱਚ ਡਰਾਈ ਫਰੂਟਸ ਵਗੈਰਾ ਪਾ ਕੇ ਤਿਆਰ ਕੀਤਾ ਜਾਂਦਾ ਹੈ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਬੱਚਿਆਂ ਦੀ ਖੁਰਾਕ ਦੇ ਵਿੱਚ ਇਸਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਦੂਸਰਾ ਹੈ ਚਿੱਲਾ ਸੂਜੀ ਬੇਸਣ ਮਿਕਸ ਕਰ ਲਿਆ ਜਾਂਦਾ ਹੈ ਜਿਸ ਦੇ ਵਿੱਚ ਪਾਇਆ ਜਾਂਦਾ ਹੈ ਦਹੀਂ ਫਿਰ ਨਾਲ ਉਸਦੇ ਵਿੱਚ ਜਿਹੜੀ ਵੀ ਹਰੀ ਸਬਜ਼ੀ ਤੁਸੀਂ ਪਾਉਣਾ ਚਾਹੋ ਉਹ ਪਾ ਕੇ